ਜੇਕਰ ਅੱਜ ਆਪਾਂ ਦੇਖੀਏ ਤਾਂ ਅੱਜ ਦੇ ਪੰਜਾਬ ਦੇ ਲੋਕ ਨੌਕਰੀਆਂ ਛੱਡ ਛੱਡ ਕੇ ਵੀ ਬਾਹਰ ਖੁਦ ਦਾ ਵਪਾਰ ਸ਼ਾ ਚਾਲੂ ਕਰਦੇ ਨੇ ਜੋ ਕਿ ਇੱਕ ਬਹੁਤ ਵਧੀਆ ਗੱਲ ਹੈ ਜੋ ਕਿ ਪੰਜਾਬ ਦੀ ਖੁੱਲ੍ਹ ਦੀ ਇਕੋਨਮੀ ਲਈ ਵੀ ਬਹੁਤ ਵਧੀਆ ਹੈ ਅਤੇ ਨਾਲ ਦੇ ਨਾਲ ਪੰਜਾਬ ਦੇ ਲੋਕਾਂ ਲਈ ਵੀ ਬਹੁਤ ਸਹੂਲਤਕਾਰੀ ਹੈ ਜਿੱਦਾਂ ਦੇਖੀਏ ਆਪਾਂ ਜੇਕਰ ਕੋਈ ਵੀ ਮੱਧ ਵਰਗ ਦਾ ਇਨਸਾਨ ਜਾਂ ਬੰਦਾ ਆਪਣਾ ਖੁਦ ਦਾ ਪੰਜਾਬ ਦੇ ਵਿੱਚ ਬਿਜ਼ਨਸ ਖੋਲ੍ਹੇਗਾ ਵੀ ਜਾਂ ਵਪਾਰ ਖੋਲ੍ਹਦਾ ਹੈ ਤਾਂ ਉਹ ਨਾਲ ਦੀ ਨਾਲ ਹੀ ਲੋਕਾਂ ਲਈ ਨੌਕਰੀਆਂ ਵੀ ਜਨਰੇਟ ਕਰ ਦਿੰਦਾ ਜੇਕਰ ਆਪਾਂ ਦੇਖਦੇ ਹਾਂ ਠੀਕ ਹੈ ਜਿਵੇਂ ਇਗਜਾਮਪਲ ਲਈਏ ਕਿ ਕੁੱਲੜ ਪਿੱਜ਼ਾ ਦਾ ਹੋ ਗਿਆ ਅਤੇ ਕੁੱਲੜ ਪੀਜ਼ਾ ਵਾਲਿਆਂ ਨੇ ਕਿੰਨੀਆਂ ਨੌਕਰੀਆਂ ਕੱਢ ਤੀਆਂ ਨਾਲ ਦੇ ਨਾਲ ਹੀ ਆਪਣੇ ਦੇਖਿਆ ਜਾਵੇ ਤਾਂ ਤਿੰਨ ਚਾਰ ਮੁੰਡੇ ਉਹਨਾਂ ਨੇ ਹੋਰ ਰੱਖੇ ਜੋ ਕਿ ਪੰਜਾਬ ਦੇ ਬੇਰੁਜ਼ਗਾਰ ਲੋਕਾਂ ਲਈ ਵੀ ਇੱਕ ਓਪਰਚੁਨਿਟੀ ਬਣ ਜਾਂਦੀ ਹੈ ਕਿ ਹਾਂ ਉਹ ਕੰਮ ਕਰ ਸਕਦੇ ਨੇ ਜੇਕਰ ਹੋਰ ਵੀ ਦੇਖੀਏ ਆਪਾਂ ਇਸ ਚੀਜ਼ ਨੂੰ ਪ੍ਰਮੋਟ ਕਰੀਏ ਤਾਂ ਇਕੋਨਮੀ ਦੀ ਵੀ ਗੱਲ ਕਰੀਏ ਤਾਂ ਪੰਜਾਬ ਦੀ ਇਕੋਨਮੀ ਵੀ ਵੱਧਦੀ ਹੈ ਇਹਦੇ ਨਾਲ ਐਂਡ ਇਸ ਕਰਕੇ ਪੰਜਾਬ ਦੇ ਲੋਕਾਂ ਲਈ ਵੀ ਬੈਨੀਫਿਟ 'ਚ ਰਹਿੰਦੀ ਹੈ ਅਤੇ ਨਾਲ ਦੇ ਨਾਲ ਹੀ ਉਹਨਾਂ ਦੀ ਇਕੋਨਮੀ ਲਈ ਵੀ ਬਹੁਤ ਬੈਨੀਫਿਟ ਦੇ ਵਿੱਚ ਰਹਿੰਦੀ ਹੈ